ਹੈਲੋ ਪ੍ਰੀਤ ਕਿੱਦਾਂ ਠੀਕ ਠਾਕ ਅੱਛਾ ਮੈਂ ਨਾ ਤੈਨੂੰ ਇੱਕ ਗੱਲ ਪੁੱਛਣੀ ਸੀ ਕਿ ਮੈਨੂੰ ਨਾ ਇੱਕ ਪੇਸ਼ਕਸ਼ ਕੋਡ ਮਿਲਿਆ ਅਤੇ ਉਹ ਪੇਸ਼ਕੋਸ਼ ਕੋਡ ਨਾਲ ਨਾ ਮੈਂ ਆਪਣੀ ਮੈਂ ਦਿੱਲੀ ਜਾਣਾ ਚਾਹੁੰਦੀ ਹਾਂ ਅਤੇ ਮੈਂ ਚਾਹੁੰਦੀ ਕਿ ਮੈਂ ਉਹ ਕੋਡ ਯੂਜ ਕਰਕੇ ਅਤੇ ਮੈਨੂੰ ਜੇ ਇਕਨੋਮਿਕਲ ਥੋੜ੍ਹਾ ਪੈਂਦਾ ਅਤੇ ਹੈ ਨਾ ਮੇਰੀ ਹੈਲਪ ਆਊਟ ਹੋ ਜਾਵੇ ਅਤੇ ਮੈਂ ਤੁਹਾਨੂੰ ਕੋਡ ਭੇਜ ਰਹੀ ਹਾਂ ਅੱਠ ਨੰਬਰਾਂ ਦਾ ਕੋਡ ਹੈਗਾ ਇਹ ਅਤੇ ਇਹਦੇ ਅਤੇ ਇਹਦੇ ਵਿੱਚ ਨਾ ਕੁਝ ਹੈਗੇ ਨਿਯਮ ਅਤੇ ਸ਼ਰਤਾਂ ਲਿਖੀਆਂ ਗਈਆਂ ਅਤੇ ਮੈਂ ਦੋ ਤਿੰਨ ਵਾਰ ਪੜ੍ਹ ਕੇ ਮੈਨੂੰ ਸਮਝ ਨਹੀਂ ਆਇਆ ਅਤੇ ਮੈਨੂੰ ਨਾ ਇੱਕ ਵਾਰ ਇਹ ਪ੍ਰੋਪਰਲੀ ਪਾਰਟੀ ਕਿਉਂਕਿ ਮੈਨੂੰ ਆ ਤਕਨੀਕੀ ਚੀਜ਼ਾਂ ਤੁਹਾਨੂੰ ਪਤਾ ਸਮਝ ਨਹੀਂ ਆਉਂਦੀਆਂ ਨਹੀਂ ਜਲਦੀ ਅਤੇ ਤੂੰ ਮੈਨੂੰ ਸਾਰਾ ਕੁਝ ਪੜ੍ਹ ਕੇ ਅਤੇ ਫਿਰ ਮੈਨੂੰ ਸਮਝਾ ਦੀ ਤਾਂ ਕਿ ਫਿਰ ਮੈਂ ਕੋਡ ਯੂਜ ਕਰਾਂ ਮੇਰੇ ਕੋਲ ਟਾਈਮ ਲਿਮਿਟ ਵੀ ਮੇਰੇ ਤੋਂ ਥੋੜ੍ਹੀ ਦੇਰ ਰਹਿ ਗਈ ਆ ਆਹੀ ਮਹੀਨਾ ਤੇ ਮੈਂ ਦਿੱਲੀ ਜਾਣ 'ਤੇ ਸੋਚ ਹੀ ਰਹੀ ਸੀ ਅਤੇ ਮੈਂ ਕਿਹਾ ਚਲੋ ਯੂਜ ਕਰ ਲਵਾਂ ਅਤੇ ਪਲੀਜ ਕਿ ਮੈਨੂੰ ਉਹਨਾਂ ਨਾਲ ਬਾਅਦ 'ਚੋਂ ਫੇਰ ਮੈਨੂੰ ਦੱਸ ਦਈ ਕਿ ਮੈਂ ਇਹਨੂੰ ਮਤਲਬ ਕਿੱਦਾਂ ਕਰਨਾ ਆ ਸਾਰਾ ਕੁਝ ਪ੍ਰੋਬਲਮ ਪ੍ਰੋਪਰਲੀ ਮੈਨੂੰ ਪੜ੍ਹ ਕੇ ਦੱਸ ਦੇ ਅਤੇ ਹੁਣ ਮੈਂ ਤਾਂ ਦੁਬਾਰਾ ਨਹੀਂ ਪੜ੍ਹਨਾ ਕਿਉਂਕਿ ਮੈਂ ਦੋ ਤਿੰਨ ਵਾਰ ਆਲਰੇਡੀ ਪੜ੍ਹ ਚੁੱਕੀ ਅਤੇ ਇਹ ਮੇਰਾ ਖਿਆਲ ਲਾਸਟ ਡੇਟ ਵੀ ਇਹਦੀ ਹੈਗੀ ਆ ਮਾਰਚ ਤੱਕ ਹੈਗੀ ਆ ਅਤੇ ਪਲੀਜ਼ ਮੈਨੂੰ ਜਲਦੀ ਦੱਸਦੀ ਠੀਕ ਹੈ ਨਾ ਚਲੋ ਕਿ ਧੰਨਵਾਦ ਤੇਰਾ